ਅੱਜ ਕੱਲ੍ਹ ਦੀ ਨਵੀਂ ਤਕਨੋਲਜੀ ਨੇ ਮਨੋਰੰਜਨ ਦੇ ਸਾਰੇ ਹੀ ਸਾਧਨ ਬਦਲ ਦਿੱਤੇ ਹਨ ਲੋਕ ਅੱਜ ਕੱਲ੍ਹ ਆਪਣੇ ਆਪਣੇ ਫੋਨ ਲੈ ਕੇ ਬੈਠੇ ਰਹਿੰਦੇ ਹਨ ਉਨ੍ਹਾਂ ਨੇ ਕੋਈ ਕਿਸੇ ਦਾ ਆਸੇ ਪਾਸੇ ਕੁਛ ਨਹੀਂ ਪਤਾ ਹੁੰਦਾ ਸਾਡੇ ਕੋਲ ਕੌਣ ਬੈਠਾ ਕੌਣ ਨਹੀਂ ਬਸ ਆਪਣੇ ਫੋਨਾਂ 'ਤੇ ਹੀ ਸੁਣਦੇ ਰਹਿੰਦੇ ਹਨ ਆਪਣੇ ਪਸੰਦ ਦੀਆਂ ਵੀਡੀਓ ਆਪਣੇ ਪਸੰਦ ਦੇ ਪ੍ਰੋਗਰਾਮ ਦੇਖਦੇ ਹਨ ਈਵਨ ਬੱਚੇ ਵੀ ਅੱਜ ਕੱਲ੍ਹ ਆਪਣੇ ਫੋਨਾਂ ਵਿੱਚ ਵਿਅਸਤ ਹੁੰਦੇ ਨੇ ਨਾ ਤਾਂ ਉਹ ਆਸੇ ਪਾਸੇ ਦੇਖਦੇ ਹਨ ਕਿ ਹੋ ਰਿਹਾ ਕੀ ਵਾਪਰ ਰਿਹਾ ਆਪਣੇ ਸਮਾਜ 'ਚ ਕੀ ਹੋ ਰਿਹਾ ਆਪਾਂ ਸਮਾਜ ਨਾਲ ਕਿਵੇਂ ਵਿਚਰਨਾ ਇਸ ਬਾਰੇ ਬੱਚਿਆਂ ਨੂੰ ਅੱਜ ਕੱਲ੍ਹ ਕੁਛ ਨਹੀਂ ਪਤਾ ਕਿਉਂਕਿ ਉਹ ਟੈਕਨੋਲੋਜੀ ਬਦ ਇੰਨੀ ਬਦਲ ਗਈ ਹੈ ਕਿ ਆਪਣੀ ਪਸੰਦ ਦਾ ਜਿਹੜਾ ਵੀ ਤੁਸੀਂ ਟੋਪਿਕ ਦੇਖਣਾ ਉਹ ਦੇਖ ਕੇ ਫੋਨ 'ਤੇ ਦੇਖ ਲੈਂਦੇ ਹੋ ਫੋਨ 'ਤੇ ਹੀ ਵੀਡੀਓ ਸੁਣਦੇ ਹੋ ਫੋਨ 'ਤੇ ਹੀ ਗਾਣੇ ਸੁਣਦੇ ਹੋ ਪਹਿਲਾਂ ਸਾਰਾ ਪਰਿਵਾਰ ਇਕੱਠਾ ਹੋ ਕੇ ਟੀ ਵੀ 'ਤੇ ਇੱਕ ਟਾਈਮ ਬੈਠਦੇ ਸੀ ਅਤੇ ਸਾਰੇ ਪਰਿਵਾਰ ਸੇਮ ਪ੍ਰੋਗਰਾਮ ਦੇਖਦੇ ਸੀ ਤਾਂ ਕਿ ਆਪਾਂ ਸੇਮ ਮਨੋਰੰਜਨ ਕਰਦੇ ਸੀ ਪਹਿਲਾਂ ਨ ਘਰਾਂ ਵਿੱਚ ਰੇਡੀਓ ਹੁੰਦੇ ਸਨ ਰੇਡੀਓ ਦਾ ਪ੍ਰੋਗਰਾਮਾਂ ਦਾ ਕੋਈ ਟਾਈਮ ਹੁੰਦਾ ਸੀ ਜੇ ਰੇਡੀਓ ਵਿੱਚ ਕੋਈ ਪ੍ਰੋਗਰਾਮ ਚੱਲਦਾ ਸੀ ਸਾਰੇ ਘਰ ਵਿੱਚ ਉਹੀ ਗਾਣੇ ਵੱਜਦੇ ਸੀ ਸਾਰਾ ਪਰਿਵਾਰ ਉਹੀ ਸੁਣਦਾ ਸੀ ਖਬਰਾਂ ਵੀ ਆਉਂਦੀਆਂ ਸੀ ਸਪੋਰਟਸ ਦਾ ਵੀ ਹੁੰਦਾ ਸੀ ਅਤੇ ਆਪਾਂ ਜਿਹੜੇ ਵੀ ਹੋਰ ਪ੍ਰੋਗਰਾਮ ਹੁੰਦੇ ਸੀ ਸਭ ਦੀ ਸਾ ਅ ਇਕੱਠੀ ਇੱਕੋ ਹੀ ਪਸੰਦ ਹੁੰਦੀ ਸੀ ਘਰ ਵਿੱਚ ਟੀ ਵੀ ਹੋਣਾ ਸਾਹਮਣੇ ਇਕੱਠੇ ਇੱਕੋ ਹੀ ਸੀਰੀਅਲ ਦੇਖਣਾ ਫਿਲਮ ਇੰਨਾ ਚਾਅ ਹੋਣਾ ਫਿਲਮਾਂ ਗਾਣੇ ਇੱਕ ਤਰ੍ਹਾਂ ਦੇ ਕਿਉਂਕਿ ਘਰ ਵਿੱਚ ਜੇ ਗਾਣੇ ਵੱਜਣੇ ਤਾਂ ਸਾਰਿਆਂ ਨੇ ਸੁਣਨੇ ਅਤੇ ਇਸ ਕਰਕੇ ਸਾਰੇ ਇਕੱਠੇ ਆਨੰਦ ਮਾਣਦੇ ਸੀ ਸਭ ਦੀ ਚੋਆਇਸ ਸੇਮ ਹੁੰਦੀ ਸੀ ਸਾਰੇ ਸੇਮ ਤਰ੍ਹਾਂ ਦੇ ਪ੍ਰੋਗਰਾਮ ਦੇਖਦੇ ਸੀ ਅੱਜ ਕੱਲ੍ਹ ਕੋਈ ਬੱਚਾ ਕੋਈ ਆਪਣੇ ਪਸੰਦ ਦਾ ਦੇਖਦਾ ਹੈ ਕੋਈ ਬੜੇ ਆਪਣੇ ਪਸੰਦ ਦੇ ਦਿੰਦੇ ਕਿਸੇ ਦੀ ਕੀ ਕੋਈ ਚੋਆਇਸ ਹੈ ਨਾ ਤਾਂ ਇਕੱਠੇ ਹੋ ਕੇ ਬੈਠਦੇ ਹਨ ਨਾ ਗੱਲਾਂ ਕਰਦੇ ਹਨ ਪਹਿਲਾਂ ਸਾਧਨ ਇਕੱਠੇ ਪਿੰਡਾਂ ਵਿੱਚ ਇੱਕ ਜਗ੍ਹਾ 'ਤੇ ਬੈਠ ਕੇ ਲੋਕ ਇਕੱਠੇ ਹੁੰਦੇ ਸੀ ਗੱਲਾਂ ਬਾਤਾਂ ਕਰਦੇ ਸੀ ਮਨੋਰੰਜਨ ਦਾ ਸਾਧਨ ਇਕੱਠੇ ਹੁੰਦੇ ਸੀ ਅਖ਼ਬਾਰ ਪੜ੍ਹਦੇ ਸੀ ਅੱਜ ਕੱਲ੍ਹ ਅਖ਼ਬਾਰ ਵੀ ਫੋਨਾਂ 'ਤੇ ਪੜ੍ਹਦੇ ਹਨ ਕੋਈ ਵੀ ਇਕੱਠੇ ਬੈਠ ਕੇ ਗੱਲਾਂ ਨਹੀਂ ਕਰਦੇ ਨਾ ਉਹਨਾਂ ਨੂੰ ਡਿਸਕਸ ਕਰਦੇ ਹਨ